ਭੰਗੜਾ ਪੰਜਾਬ ਦਾ ਪ੍ਰਮੁੱਖ ਲੋਕ ਨਾਚ ਹੈ ਇਹ ਨਾਚ ਹਰ ਖੁਸ਼ੀ ਦੇ ਮੌਕੇ 'ਤੇ ਨੱਚਿਆ ਜਾਂਦਾ ਹੈ ਭੰਗੜਾ ਖਾਸ ਤੌਰ 'ਤੇ ਕਣਕ ਦੀ ਵਾਢੀ ਤੋਂ ਬਾਅਦ ਵਿਸਾਖੀ ਦੇ ਮੇਲੇ 'ਤੇ ਨੱਚਿਆ ਜਾਂਦਾ ਹੈ ਭੰਗੜਾ ਪੰਜਾਬ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਪ੍ਰਚਲਿਤ ਲੋਕ ਨਾਚ ਹੈ ਇਹ ਨਾਚ ਨੱਚਣ ਵਾਲਿਆਂ ਦਾ ਪਹਿਰਾਵਾ ਕੁੜਤਾ ਅਤੇ ਚਾਦਰਾ ਗਲਾਂ ਦੇ ਵਿੱਚ ਕੈਂਠੇ ਅਤੇ ਕੰਨਾਂ ਦੇ ਵਿੱਚ ਨੱਤੀਆਂ ਅਤੇ ਨੋਕ ਵਾਲੀ ਜੁੱਤੀ ਹੁੰਦੀ ਹੈ ਇਸ ਇਸ ਪਹਿਰਾਵੇ ਰਾਹੀਂ ਇਹ ਆਪਣੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਹਨ ਭੰਗੜਾ ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਹੈ ਹਰ ਖੁਸ਼ੀ ਦੇ ਮੌਕੇ 'ਤੇ ਲੋਹੜੀ 'ਤੇ ਭੰਗੜੇ ਨੂੰ ਹਮੇਸ਼ਾ ਪਹਿਲ ਦਿੱਤੀ ਜਾਂਦੀ ਹੈ ਪੁਰਾਣੇ ਸਮਿਆਂ ਦੇ ਵਿੱਚ ਭੰਗੜਾ ਗੱਭਰੂਆਂ ਦੁਆਰਾ ਨੱਚਿਆ ਜਾਂਦਾ ਸੀ ਪਰ ਅਜੋਕੇ ਸਮੇਂ ਵਿੱਚ ਭੰਗੜਾ ਮੁਟਿਆਰਾਂ ਵੱਲੋਂ ਵੀ ਪਾਇਆ ਜਾਂਦਾ ਹੈ ਭੰਗੜੇ ਦੀ ਪੰਜਾਬੀਆਂ ਲਈ ਬਹੁਤ ਜ਼ਿਆਦਾ ਮਹੱਤਤਾ ਹੈ